ਹੈਲੋ ਹੈਲੋ ਬੋਲਦੇ ਹਾਂਜੀ ਅਸੀਂ ਫੋਨ ਖਰੀਦਣਾ ਸੀਗਾ ਅਤੇ ਫੋਨ ਉਹ ਲੈਣਾ ਜਿਹਦਾ ਵਧੀਆ ਕੈਮਰਾ ਚੱਲੇ ਅਤੇ ਵਧੀਆ ਵੀਡੀਓ ਕਾਲ ਵਧੀਆ ਹੋਵੇ ਜਿਹਦਾ ਨੈੱਟ ਬਹੁਤ ਵਧੀਆ ਚੱਲੇ ਨੈਟ ਵੀ ਇੰਨਾ ਹੋਣਾ ਚਾਹੀਦਾ ਜੇ ਕੰਪਨੀ ਕੁਮਪਣੀ ਦਾ ਤਾਂ ਮੈਨੂੰ ਖ਼ਾਸ ਕਰਕੇ ਨਹੀਂ ਪਤਾ ਹੈਗਾ ਮੈਨੂੰ ਤਾਂ ਬਸ ਫੋਨ ਵੀ ਵਧੀਆ ਦੱਸ ਕੇ ਲੈ ਲੈਣਾ ਮੈਂ ਜਿਹਦੇ 'ਚ ਕੈਮਰਾ ਵਧੀਆ ਹੋਵੇ ਅਤੇ ਨੈਟ ਵਧੀਆ ਜਿਹਦੇ 'ਚ ਵੀਡੀਓ ਕਾਲ ਵੀਡੀਓ ਕਾਲ ਕਰ ਸਕਾਂ ਘਰ ਵੀਡੀਓ ਕਾਲ ਕਰਨੀ ਹੁੰਦੀ ਹੈ ਨਾ ਉਹਦੇ 'ਚ ਦਿੱਕਤ ਆਉਂਦੀ ਹੈ ਹਾਂ ਹਾਂ ਆਈ ਫੋਨ ਦਾ ਤਾਂ ਚੱਕਰ ਪੈਂਦਾ ਨਾ ਮੈਨੂੰ ਚਲਾਉਣਾ ਨਹੀਂ ਆਉਂਦਾ ਫਿਰ ਇਸ ਕਰਕੇ ਮੈਂ ਉਹ ਉ ਲੈਣਾ ਹੈਗਾ ਫਿਰ ਮੈਨੂੰ ਉਹ ਦੋ ਦੂਜੇ ਹੀ ਚਾਹੀਦੇ ਦੇਸੀ ਆ ਥੱਲੇ ਜੋ ਕੰਪਨੀਆਂ ਜਿਹੜੀਆਂ ਹੁੰਦੀਆਂ ਨੇ

ਅੱਛਾ ਪਹਿਲਾਂ ਮੈਂ ਓਪੋ ਵਾਲੇ ਚਲਾਉਂਦੀ ਪਈ ਚਲਾ ਰਹੀ ਸੀ ਅਤੇ ਉਹ ਉਹਦੇ ਪਰ ਉਹਦੇ 'ਚ ਵੀ ਹੋਏਗਾ ਸਿਸਟਮ ਮੈਂ ਪਹਿਲਾਂ ਓਪੋ ਦਾ ਚਲਾਉਂਦੀ ਹਾਂ ਨਾ ਸਿਸਟਮ ਉਹਦੇ ਵਿੱਚ ਉਵੇਂ ਦਾ ਹੀ ਹੋਵੇਗਾ ਕਿ ਜਾਂ ਹੋਰ ਤਰੀਕੇ ਦਾ ਹੋਏਗਾ ਕਿਉਂਕਿ ਮੈਨੂੰ ਮੈਂ ਪੜ੍ਹੀ ਲਿਖੀ ਨਹੀਂ ਨਾ ਹੈਗੀ ਮੈਨੂੰ ਇੰਨੀ ਛੇਤੀ ਪਤਾ ਨਹੀਂ ਲੱਗਦਾ ਜੇ ਸਿਸਟਮ ਓਵੇਂ ਦਾ ਹੋਵੇ ਅੱਛਾ ਠੀਕ ਹੈ ਅਤੇ ਹੋਰ ਫਿਰ ਉਹਦੇ 'ਤੇ ਕੀ ਰਿਆਇਤ ਰੂਤ ਹਾਂ ਹਾਂ ਅੱਛਾ ਅਤੇ ਇਹਦਾ ਫਿਰ ਇਹਦਾ ਰੇਟ ਰੂਟ ਕਿਵੇਂ ਹੋਏਗਾ ਅੱਛਾ ਅਤੇ ਰਿਆਇਤ ਅੱਛਾ ਡਿਸਕਾਊਂਟ ਦਾ ਡਿਸਕਾਊਂਟ ਹੈਗਾ ਅੱਛਾ ਅੱਛਾ ਉਹਦੇ ਨਾਲ ਦਿੰਦੇ ਹੋ ਹੈ ਠੀਕ ਹੈ ਚਲੋ ਉਹ ਤਾਂ ਆਪਾਂ ਸਲਾਹ ਕਰ ਲਾਂਗੇ ਨਾ ਫਿਰ ਜੇ ਆਪਾਂ ਕਿਸ਼ਤਾਂ 'ਤੇ ਲੈਣਾ ਹੋਇਆ ਕਿਸ਼ਤਾਂ 'ਤੇ ਲੈ ਲਾਂਗੇ ਜੇ ਉਦਾਂ ਲੈਣਾ ਹੋਇਆ ਉਦਾਂ ਲੈ ਲਾਂਗੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਹਾਂ ਠੀਕ ਹਾਂ ਹਾਂ ਠੀਕ ਹੈ ਫਿਰ ਆਪਾਂ ਦੇਖ ਲਾਂਗੇ ਹੈ ਨਹੀਂ ਨਾ ਮੈਂ ਨਾ ਨਾ ਮੈਨੇ ਨਹੀਂ ਬਣਾਇਆ ਹੈਗਾ ਹਾਂ ਵੀ ਉਹ ਤਾਂ ਚਲੋ ਅਸੀਂ ਆਪਾਂ ਸਲਾਹ ਕਰ ਲਾਂਗੇ ਨਾ ਜੇ ਅਸੀਂ ਨਗਦ ਲੈਣ ਹੋਇਆ ਤਾਂ ਨਗਦ ਲੈ ਲਾਂਗੇ ਜੇ ਅਸੀਂ ਕਿਸ਼ਤ ਜੇ ਅਸੀਂ ਕਿਸ਼ਤਾਂ 'ਤੇ ਕਰਨਾ ਹੋਇਆ ਤਾਂ ਕਿਸ਼ਤਾਂ 'ਤੇ ਕਰ ਲਾਂਗੇ ਉਹ ਵੀ ਚਲੋ ਆਰਾਮ ਨਾਲ ਚੱਲੀਆਂ ਜਾਂਦੀਆਂ ਨੇ ਫਿਰ ਹਾਂ ਅਤੇ ਦੁਕਾਨ ਹਾਂ ਹਾਂ ਅੱਛਾ ਅੱਛਾ ਅੱਛਾ ਫਿਰ ਅੱਗੇ ਹੋਰ ਵੀ ਮਿਲ ਜਾਂਦੀ ਹੈ ਠੀਕ ਅਤੇ ਇੱਧਰ ਇੱਧਰ ਅੱਛਾ ਠੀਕ ਹੈ ਅਤੇ ਦੁਕਾਨ ਹਰ ਰੋਜ ਖੁੱਲ੍ਹੀ ਰਹਿੰਦੀ ਹੈ ਕਿ ਜਾਂ ਠੀਕ ਹੈ ਹਾਂ ਅੱਛਾ ਕੱਲ੍ਹ ਕਿਸੇ ਵੀ ਟਾਈਮ ਅਸੀਂ ਆ ਸਕਦੇ ਹਾਂ ਠੀਕ ਹੈ ਠੀਕ ਹੈ ਚਲੋ ਫਿਰ ਆਵਾਂਗੇ ਕੱਲ੍ਹ ਨੂੰ ਫਿਰ ਅਸੀਂ ਲੀ ਲੈ ਲਾਂਗੇ ਜਿਵੇਂ ਵੀ ਲੈਣਾ ਹੋਇਆ ਜਿੰਨਾ ਕੁ ਤੇ ਲੈਣਾ ਹੋਇਆਂ ਉਨਾਂ ਕੁ ਵੀ ਜੇ ਕਿਸ਼ਤਾਂ ਕਰਨੀਆਂ ਤਾਂ ਕਿਸ਼ਤਾਂ ਕਰ ਲਾਂਗੇ ਹਾਂ ਚਲੋ ਠੀਕ ਹਾਂਜੀ ਠੀਕ ਹੈ ਠੀਕ ਹੈ ਚੰਗਾ ਓਕੇ